ਕੋਵਿਡ ਉੱਨੀ ਮਹਾਂਮਾਰੀ ਬਾਰੇ ਤਾਂ ਕੁਝ ਦੱਸਣ ਦੀ ਲੋੜ ਹੀ ਨਹੀਂ ਕਿਉਂਕਿ ਉਸ ਸਮੇਂ ਦੌਰਾਨ ਇੰਨਾ ਕੁ ਪ੍ਰਭਾਵ ਆਪਾਂ ਇਲਾਕਾ ਨਾ ਕਹੀਏ ਤਕਰੀਬਨ ਸਾਰੇ ਸੀਗਾ ਇੰਨਾ ਕੁ ਪ੍ਰਭਾਵਿਤ ਹੋਈ ਦੁਨੀਆ ਕਿ ਕਈਆਂ ਦੇ ਤਾਂ ਬਿਜ਼ਨੈਂਸ ਹਿੱਲ ਗਏ ਜੁਗਾੜ ਹਿੱਲ ਗਏ ਸਾਰੇ ਅਤੇ ਪਰ ਐਟਮੋਸਫੀਅਰ ਨੂੰ ਮਤਲਬ ਕਿ ਜਿਹੜੀ ਆਪਣਾ ਵਾਤਾਵਰਨ ਇਹਨੂੰ ਬਹੁਤ ਫਾਇਦਾ ਹੋਇਆ ਕਿਉਂਕਿ ਇੱਥੇ ਮੈਂ ਫਤਿਹਗੜ੍ਹ ਸਾਹਿਬ ਨੂੰ ਜਦੋਂ ਕਦੇ ਡਿਊਟੀ 'ਤੇ ਆਉਣਾ ਇੱਥੋਂ ਦੇਖਣਾ ਪਹਾੜੀ ਏਰੀਆ ਜਿਹੜਾ ਹਿਮਾਚਲ ਦਾ ਪੂਰੀ ਕਈ ਕਈ ਜਗ੍ਹਾ 'ਤੇ ਤਾਂ ਬਰਫ ਜੰਮੀ ਇਵਨ ਕਿ ਬਰਫ ਜੰਮੀ ਵੀ ਐਨ ਕਲੀਅਰ ਦਿੱਖਦੀ ਸੀਗੀ ਮੌਸਮ ਵਾਤਾਵਰਨ ਬਹੁਤ ਜ਼ਿਆਦਾ ਕਲੀਅਰ ਹੋ ਗਿਆ ਸੀਗਾ ਕੋਈ ਸਾਹ ਲੈਣ 'ਚ ਤਕਲੀਫ ਨਹੀਂ ਸੀ ਪਰ ਇਹਨੇ ਇੱਕ ਕਈਆਂ ਦਾ ਫਾਇਦਾ ਵੀ ਕੀਤਾ ਨੁਕਸਾਨ ਵੀ ਕੀਤਾ ਫਾਇਦਾ ਇਹ ਕੀਤਾ ਕਿ ਜਿਹੜੀਆਂ ਬੁੜੀਆਂ ਕਿਸੇ ਨਾ ਕਿਸੇ ਬਹਾਨਾ ਲਾ ਕੇ ਰੋਜ਼ ਹਸਪਤਾਲ ਨੂੰ ਤੁਰੀਆਂ ਰਹਿੰਦੀਆਂ ਤੀਆਂ ਉਹਨਾਂ ਨੂੰ ਕੋਈ ਬ ਦਵਾਈ ਦੀ ਲੋੜ ਨਹੀਂ ਕੋਈ ਕਾਸੇ ਦੀ ਲੋੜ ਨਹੀਂ ਘਰ ਆਰਾਮ ਨਾਲ ਬੈਠੀਆਂ ਸਾਰਾ ਦਿਨ ਉਹਨਾਂ ਦੇ ਗੋਡੇ ਵੀ ਠੀਕ ਹੋ ਗਏ ਉਨ੍ਹਾਂ ਦਾ ਸਾਹ ਵੀ ਠੀਕ ਹੋ ਗਏ ਪੂਰਾ ਚੱਲਦਾ ਰਿਹਾ ਕੰਮ ਵਧੀਆ ਪਰ ਜਿਵੇਂ ਸਾਡੀ ਸੈਸ਼ਲ ਸੈਸ਼ਨਲ ਡਿਊਟੀ ਸੀ ਸਾਨੂੰ ਆਉਣਾ ਜਾਣਾ ਪੈਂਦਾ ਸੀਗਾ ਪਰ ਕਈ ਜਗ੍ਹਾ 'ਤੇ ਜਦ ਪੁਲਿਸ ਦਾ ਨਾਕਾ ਹੋਇਆ ਪੁਲਿਸ ਦਾ ਡਰ ਵੀ ਹੋਇਆ ਕਰੇ ਅਸੀਂ ਤਾਂ ਆਪ ਆਪਣੇ ਆਪਣੇ ਬਲ ਦੇ ਨਾਲ ਆਪਣੀ ਡਿਊਟੀ ਕਰਦੇ ਰਹੇ ਹਾਂ ਅਤੇ ਕਦੇ ਮਿੰਨਤ ਤਰਲਾ ਕਰਨਾ ਕਦੇ ਲੁੱਕ ਕੇ ਲੰਘਣਾ ਕਦੇ ਕਿਵੇਂ ਲੰਘਣਾ ਜਾਣੀ ਮਾਸਕ ਮੁਸਕ ਆਪਣਾ ਵਗੈਰਾ ਲਾ ਕੇ ਰੱਖਦੇ ਸੀਗੇ ਜੋ ਉਹਨਾਂ ਦੇ ਇੰਸਟਰਕਸ਼ਨਾਂ ਤੀਆਂ ਉਹਨਾਂ ਦੇ ਪੂਰੇ ਖਰੇ ਉੱਤਰਦੇ ਸੀਗੇ ਜਾ ਕੇ ਅਸੀਂ ਆਪਣੀ ਡਿਊਟੀ ਲਾਉਣ ਵਿੱਚ ਕਾਮਯਾਬ ਵੀ ਹੋ ਜਾਂਦੇ ਸੀਗੇ ਪਰ ਪ੍ਰਭਾਵਿਤ ਤਾਂ ਬਹੁਤ ਕੀਤਾ ਇਹਨੇ ਸੈਰ ਸਪਾਟਾ ਤਾਂ ਬਿਲ ਖਤਮ ਹੀ ਹੋ ਗਿਆ ਸੀਗਾ ਲੋਕ ਤਾਂ ਘਰਾਂ 'ਚ ਵਾੜਤੇ ਮੋਦੀ ਨੇ ਹੈਂ ਇਹ ਕਿਵੇਂ ਨਿਕਲਿਆ ਬਾਹਰ ਇਸ ਕਰਕੇ ਵੀ ਮਹਾਂਮਾਰੀ ਨੇ ਜੋ ਐਟਮੋਸਫੀਅਰ ਨੂੰ ਵਾਤਾਵਰਨ ਨੂੰ ਸਾਫ ਸੁਥਰਾ ਕੁਝ ਸਮੇਂ ਲਈ ਰੱਖਿਆ ਉੱਥੇ ਸੈਰ ਸਪਾਟੇ ਨੂੰ ਅਤੇ ਲੋਕਾਂ ਦਾ ਕੰਮ ਕਾਰ ਨੂੰ ਪ੍ਰਭਾਵਿਤ ਬਹੁਤ ਕੀਤਾ